ਸਾਡੇ ਆਲੇ ਦੁਆਲੇ ਇਹੋ ਜਿਹੇ ਬਹੁਤ ਪਸ਼ੂ ਪਾਲਕ ਹਨ ਜੋ ਕਿ ਵੱਖ ਵੱਖ ਸਕੀਮਾਂ ਦਾ ਫਾਇਦਾ ਲੈ ਰਹੇ ਹਨ ਇਸ ਤੋਂ ਉਹਨਾਂ ਨੂੰ ਸਰਕਾਰੀ ਸਕੀਮਾਂ ਤੋਂ ਮਦਦ ਮਿਲਦੀ ਹੈ ਜਿਵੇਂ ਉਹਨਾਂ ਨੂੰ ਕਈ ਵਾਰੀ ਜਾਨਵਰਾਂ ਦੀ ਬਿਮਾਰੀ 'ਤੇ ਅਤੇ ਜ ਜਾਨਵਰਾਂ ਦੇ ਲਈ ਵੱਖਰੇ ਵੱਖਰੇ ਤੌਰ 'ਤੇ ਸ਼ੈੱਡ ਵੀ ਮਿਲਦੇ ਹਨ ਜਿਸ ਰਾਹੀਂ ਪਸ਼ੂ ਪਾਲਕਾਂ ਲਈ ਇ ਪਸ਼ੂਆਂ ਨੂੰ ਰੱਖਣਾ ਇੱਕ ਸੁਵਿਧਾਜਨਕ ਸ੍ਰੋਤ ਬਹੁਤ ਜ਼ਿਆਦਾ ਹੈ ਉਸ ਤੋਂ ਬਾਅਦ ਸਰਕਾਰੀ ਡੇਰੀ ਵਾਲੇ ਵੀ ਹੁੰਦੇ ਹਨ ਜੋ ਕਿ ਉਹਨਾਂ ਕੋਲੋਂ ਉਹਨਾਂ ਦੇ ਘਰ ਆ ਕੇ ਉਹਨਾਂ ਤੋਂ ਦੁੱਧ ਲੈ ਜਾਂਦੇ ਹਨ ਅਤੇ ਮਹੀਨੇ ਦੇ ਮਹੀਨੇ ਉਹਨਾਂ ਨੂੰ ਪੈਸੇ ਦੇ ਦਿੰਦੇ ਹਨ